ਮੇਰੇ ਪਿੰਡ ਵਿੱਚ ਵੀ ਇੱਕ ਖੂਹ ਹੈ ਜਿੱਥੇ ਪਹਿਲਾਂ ਹੀ ਇੱਕ ਜਣਾ ਰੱਸੀ ਨਾਲ ਬੰਨ੍ਹ ਕੇ ਬਾਲਟੀਆਂ ਨਾਲ ਪਾਣੀ ਭਰ ਰਿਹਾ ਸੀ ਫਿਰ ਮੈਂ ਵੀ ਉੱਥੋਂ ਉਸ ਬਾਲਟੀ ਨਾਲ ਪਾਣੀ ਭਰ ਕੇ ਆਪ ਤਾਂ ਪੰਡ ਲੈ ਕੇ ਗਿਆ ਸੀ ਉਹਦੇ ਵਿੱਚ ਪਾ ਲਿਆ ਖੂਹ ਤੋਂ ਪਾਣੀ ਕੱਢਣ ਦਾ ਇਹ ਇੱਕ ਬਹੁਤ ਵਧੀਆ ਤਰੀਕਾ ਸੀ ਇਲੈਕਟਰਿਕ ਮੋਟਰ ਦੀ ਵਰਤੋਂ ਵੀ ਖੂਹ 'ਚੋਂ ਪਾਣੀ ਕੱਢਣ ਵਿੱਚ ਕੀਤੀ ਜਾ ਸਕਦੀ ਹੈ ਇਹ ਲਾਈਟ ਨਾਲ ਅਟੈਚ ਹੋ ਕੇ ਮੋਟਰ ਚਲਾਈ ਜਾਂਦੀ ਹੈ ਇਹਦੇ ਨਾਲ ਵੀ ਖੂਹ 'ਚੋਂ ਪਾਣੀ ਕੱਢਿਆ ਜਾਂਦਾ ਹੈ ਇਸ ਨਾਲ ਖੂਹ 'ਚੋਂ ਪਾਣੀ ਕੱਢ ਕੱਢਣਾ ਸੌਖਾ ਹੋ ਜਾਂਦਾ ਹੈ ਇਸ ਨਾਲ ਕੋਈ ਆਪਦਾ ਸਰੀਰਿਕ ਬਲ ਵੀ ਜ ਨਹੀਂ ਲੱਗਦਾ ਮੋਟਰ ਨਾਲ ਖੂਹ 'ਚੋਂ ਪਾਣੀ ਕੱਢ ਕੇ ਆਪਾਂ ਫਸਲਾਂ ਨੂੰ ਵੀ ਪਾਣੀ ਦੇ ਸਕਦੇ ਹਾਂ ਇਲੈਕਟ੍ਰੋਨਿਕ ਮੋਟਰ ਨਾਲ ਪਾਣੀ ਕੱਢਣਾ ਅੱਜ ਕੱਲ੍ਹ ਦਾ ਆਮ ਸਰਲ ਅਤੇ ਸੌਖਾ ਤਰੀਕਾ ਹੈ ਇਹਦੇ ਵਿੱਚ ਸਰੀਰਕ ਬਲ ਵੀ ਨਹੀਂ ਲੱਗਦਾ